ਮੈਂ ਐਮਜੋਨ ਤੋਂ ਇੱਕ ਪਾਵਰ ਬੈਂਕ ਮੰਗਵਾਇਆ ਸੀਗਾ ਉਹ ਪਾਵਰ ਬੈਂਕ ਮੈਨੂੰ ਬੜੇ ਸਹੀ ਰੇਟ 'ਤੇ ਮਿਲ ਗਿਆ ਕਿਉਂਕਿ ਔਫਰ ਚੱਲਦੇ ਪਏ ਸੀ ਔਫਰ ਚੱਲਦੇ ਪਏ ਸੀ ਤਾਂ ਮੈਨੂੰ ਆਪਦੇ ਸੈਵਨਟੀ ਪ੍ਰਸੈਂਟ ਆਫ 'ਤੇ ਉਹ ਮੈਨੂੰ ਮਿਲ ਗਿਆ ਉਹ ਵੀ ਐਮਜ਼ੋਨ 'ਤੇ ਐਮਜ਼ੋਨ 'ਤੇ ਇੰਨੀ ਸਸਤੀ ਚੀਜ਼ ਮਿਲਣਾ ਤਾਂ ਘੱਟ ਹੀ ਹੈ ਹੈ ਨਾ ਅਤੇ ਮੈਂ ਉੱਥੇ ਮੰਗਵਾਇਆ ਅਤੇ ਉਹ ਬੋਟ ਕੰਪਨੀ ਦਾ ਇੱਕਦਮ ਵਧੀਆ ਕੰਪਨੀ ਹੈਗੀ ਆ ਉਹਦੇ 'ਤੇ ਜਦ ਮੈਂ ਉਹਨੂੰ ਮੰਗਵਾਇਆ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਇੰਨਾ ਸਸਤਾ ਮਿਲਦਾ ਪਿਆ ਫਿਰ ਜਦੋਂ ਮੈਂ ਮੰਗਵਾਇਆ ਉਹ ਜ ਜਿੰਨੀ ਤਰੀਕ 'ਤੇ ਲਿਖਿਆ ਸੀਗਾ ਉਸ ਦਿਨ ਹੀ ਆਇਆ ਜਿੰਨਾ ਟਾਈਮ ਲਿਖਿਆ ਸੀਗਾ ਉਹਦੀ ਡਿਲੀਵਰੀ ਕਰਕੇ ਗਿਆ ਡਿਲੀਵਰੀਮੈਨ ਡਿਲੀਵਰੀਮੈਨ ਵੀ ਬੜਾ ਵਧੀਆ ਸੀਗਾ ਬੜੇ ਸ਼ਾਂਤ ਸੁਭਾਅ ਦਾ ਸੀਗਾ ਬੜਾ ਚੰਗਾ ਬੋਲਦਾ ਸੀਗਾ ਕੋਈ ਉਹਨੇ ਗਲਤ ਗੱਲ ਨਹੀਂ ਕੀਤੀ ਆਰਾਮ ਨਾਲ ਆਇਆ ਸਹੀ ਬੋਲਿਆ ਸਹੀ ਚੰਗੀ ਤਰ੍ਹਾਂ ਓ ਟੀ ਪੀ ਮੰਗਿਆ ਆਰਾਮ ਨਾਲ ਆ ਕੇ ਚਲਿਆ ਗਿਆ ਜਿਹੜਾ ਪਾਵਰ ਬੈਂਕ ਹੈਗਾ ਪਾਵਰ ਬੈਂਕ ਤਾਂ ਬਹੁਤ ਹੀ ਜ਼ਿਆਦਾ ਚੰਗਾ ਹੈਗਾ ਉਹਦੇ 'ਚ ਚਾਰ ਲਾਈਟਾਂ ਹੈਗੀਆਂ ਜਦੋਂ ਉਹਨੂੰ ਚਾਰਜ ਲਾਉਂਦੇ ਹਾਂ ਤਾਂ ਇੱਕ ਲਾਈਟ ਬਲਿੰਕ ਕਰਦੀ ਹੁੰਦੀ ਆ ਜਿਹੜੀ ਲਾਈਟ ਬਲਿੰਕ ਕਰਦੀ ਆ ਮਤਲਬ ਕਿ ਹੁੰਦਾ ਉਹ ਚਾਰਜ ਹੈਗਾ ਜਦੋਂ ਚਾਰੋਂ ਲਾਈਟਾਂ ਬਲਿੰਕ ਕਰਨੀਆਂ ਬੰਦ ਹੋ ਗਈਆਂ ਇਹਦਾ ਮਤਲਬ ਉਹ ਪੂਰਾ ਚਾਰਜ ਹੋ ਗਿਆ ਚਾਰ ਲਾਈਟ ਜਿਹੜੀ ਅੰਦਰਲੀ ਲਾਈਟ ਹੈਗੀ ਆ ਜਦੋਂ ਆਪਾਂ ਚਾਰਜ ਲਾਉਂਦੇ ਹਾਂ ਉਹ ਗਰੀਨ ਹੋ ਜਾਂਦੀ ਹੈ ਮਤਲਬ ਕਿ ਜਿਹੜਾ ਤੁਹਾਡਾ ਫੋਨ ਹੈਗਾ ਉਹ ਫਾਸਟਲੀ ਚਾਰਜ ਹੁੰਦਾ ਪਿਆ ਜਿਵੇਂ ਬਾਕੀ ਜਿਹੜੇ ਪਾਵਰ ਬੈਂਕ ਹੈਗੇ ਆ ਟਾਈਮ ਲਾਉਂਦੇ ਆ ਚਾਰਜ ਲੇਕਿਨ ਇਹ ਤੇਜ਼ ਤੇਜ਼ ਚਾਰਜ ਕਰਦਾ ਜਿੰ ਜਿਵੇਂ ਆਪਾਂ ਸਹੀ ਉਵੇਂ ਚਾਰਜ ਕਰਦੇ ਹੋਏ ਓਨਾ ਸਹੀ ਚਾਰਜ ਕਰਦਾ ਉਹਦਾ ਕਲਰ ਵੀ ਇੱਕਦਮ ਵਧੀਆ ਹੈਗਾ ਬੜਾ ਸੋਹਣਾ ਰੰਗ ਆਇਆ ਹੈਗਾ ਉਹਦਾ ਜਿਵੇਂ ਐਮੇਜ਼ੋਨ ਨੇ ਉੱਥੇ ਡਿਸਪਲੇ ਕੀਤਾ ਸੀਗਾ ਉਵੇਂ ਜਿਵੇਂ ਉਵੇਂ ਹੀ ਆਇਆ ਹੈਗਾ ਉਹਦੇ 'ਚ ਕੋਈ ਹੈਗੀ ਨਹੀਂ ਉਹਨੂੰ ਆਪਾਂ ਚਾਰਜ ਲਾ ਕੇ ਪਾਵਰ ਬੈਂਕ ਨੂੰ ਨਾਲ ਨਾਲ ਆਪਦਾ ਫੋਨ ਵੀ ਚਾਰਜ ਕਰ ਸਕਦੇ ਹਾਂ ਉਵੇਂ ਪਾਵਰ ਬੈਂਕ ਵੀ ਚਾਰਜ ਹੋਜੂਗਾ ਅਤੇ ਆਪਦਾ ਫੋਨ ਵੀ ਚਾਰਜ ਹੋਜੂਗਾ ਦੋਵਾਂ ਚੀਜ਼ਾਂ ਇਕੱਠੀਆਂ ਚਾਰਜ ਹੋਈ ਜਾਣਗੀਆਂ ਲੇਕਿਨ ਐਵੇਂ ਐਵੇਂ ਚਾਰਜ ਇੱਥੋਂ ਥੋੜ੍ਹਾ ਜਿਹਾ ਹੁੰਦਾ ਲੇਕਿਨ ਐਵੇਂ ਦੋਵੇਂ ਚੀਜ਼ਾਂ ਇਕੱਠੀਆਂ ਚਾਰਜ ਹੋ ਜਾਂਦੀਆਂ ਜਦੋਂ ਮੈਂ ਜਾਂਦਾ ਸੀਗਾ ਨਾ ਮੇਰਾ ਫੋਨ ਬੰਦ ਹੋ ਜਾਂਦਾ ਸੀ ਮੈਨੂੰ ਬਹੁਤ ਦਿੱਕਤ ਹੁੰਦੀ ਸੀਗੀ ਫਿਰ ਹੁਣ ਮੈਂ ਜਾਦਾ ਮੈਂ ਉਹਨੂੰ ਨਾਲ ਲੈ ਕੇ ਜਾਂਦਾ ਮੈਨੂੰ ਫੋਨ ਬੰਦ ਹੋਣ ਦਾ ਕੋਈ ਡਰ ਨਹੀਂ ਰਹਿੰਦਾ ਹਾਂ ਮੈਂ ਜਿੰਨਾ ਮਰਜ਼ੀ ਟਰੈਵਲ ਕਰੂੰ ਮੈਂ ਕਰ ਸਕਦਾ ਆਰਾਮ ਨਾਲ ਕਰ ਸਕਦਾ ਅਤੇ ਆਪਦੇ ਘਰ ਵਾਲਿਆਂ ਨਾਲ ਸੰਪਰਕ ਰੱਖ ਸਕਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਮੈਂ ਕਿੱਥੇ ਜਾਂਦਾ ਕਿਉਂਕਿ ਮੈਨੂੰ ਆਰਾਮ ਨਾਲ ਫੋਨ ਲਾ ਕੇ ਪੁੱਛ ਸਕਦੇ ਕਿਉਂਕਿ ਮੈਂ ਆਪਦਾ ਫੋਨ ਆਪਦਾ ਕਿਤੇ ਵੀ ਤੁਰਦੇ ਫਿਰਦੇ ਕਿਤੇ ਵੀ ਚਾਰਜ ਕਰ ਸਕਦਾ ਹੈਗਾ